ਖਾਣਾ ਬਣਾਉਂਦੇ ਸਮੇਂ ਵੱਖ ਵੱਖ ਕਿਸਮ ਦੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਸਭ ਤੋਂ ਪਹਿਲਾਂ ਤਾਂ ਇਹੀ ਵੇਖਣਾ ਹੈ ਕਿ ਗੈਸ ਕਿਤੋਂ ਲੀਕ ਤਾਂ ਨਹੀਂ ਹੋ ਰਹੀ ਫਿਰ ਇਹ ਦੇਖਣਾ ਹੈ ਕਿ ਜਿਹੜੇ ਕਿਚਨ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਉਹ ਹਵਾਦਾਰ ਹੈ ਕਿ ਰੱਬ ਨਾ ਕਰੇ ਕਿ ਕਿਤੇ ਨਾ ਕੋਈ ਹਾਨੀ ਨਾ ਹੋ ਜਾਏ ਫਿਰ ਜਦੋਂ ਅਸੀਂ ਖਾਣਾ ਬਣਾ ਰਹੇ ਆ ਅਤੇ ਜਿਹੜੀ ਉਹਦੀ ਫਲੇਮ ਹੈ ਉਹ ਵੀ ਠੀਕ ਹੋਣੀ ਚਾਹੀਦੀ ਹੈ ਹੈ ਨਾ ਹੋਵੇ ਕਿ ਸਾਡੇ ਕੱਪੜੇ ਇੰਨੇ ਕੁ ਢਿੱਲੇ ਹੋਣ ਲੰਬੀਆਂ ਬਾਹਵਾਂ ਵਾਲੇ ਹੋਣ ਤਾਂ ਕਿ ਉਹਦੇ ਨਾਲ ਉਹ ਅੱਗ ਨੂੰ ਹੀ ਫੜ ਲੈਣ ਬਹੁਤ ਜ਼ਿਆਦਾ ਢਿੱਲੇ ਕੱਪੜੇ ਨਹੀਂ ਪਾਉਣੇ ਚਾਹੀਦੇ ਬਹੁਤ ਜ਼ਿਆਦਾ ਰਸ਼ ਵੀ ਨਹੀਂ ਭੀੜ ਵੀ ਨਹੀਂ ਇਕੱਠੀ ਕਰਨੀ ਚਾਹੀਦੀ ਹੈ ਕਿਚਨ ਦੇ ਵਿੱਚ ਕਿ ਕਿਚਨ ਛੋਟਾ ਹੋਵੇ ਅਤੇ ਲੋਕ ਜ਼ਿਆਦਾ ਖੜ੍ਹੇ ਹੋਣ ਉਹਦੇ ਨਾਲ ਫਿਰ ਸਾਵਧਾਨੀ ਨਹੀਂ ਰਹਿੰਦੀ ਹੈ ਧਿਆਨ ਗੱਲਾਂ ਵੱਲ ਚਲਾ ਜਾਂਦਾ ਹੈ ਠੀਕ ਹੈ ਅਤੇ ਇਸ ਤੋਂ ਵੱਧ ਕਿ ਹੈ ਵੀ ਦੇਖਣਾ ਚਾਹੀਦਾ ਹੈ ਕਿ ਜਦੋਂ ਅਸੀਂ ਗੈਸ ਬਣਾ ਕੇ ਆਪਣਾ ਖਾਣਾ ਪੂਰਾ ਬਣਾ ਕੇ ਕਿਚਨ ਤੋਂ ਬਾਹਰ ਆਉਣਾ ਹੈ ਅਤੇ ਚੰਗੀ ਤਰ੍ਹਾਂ ਪਹਿਲਾਂ ਚੈੱਕ ਕਰ ਲਈਏ ਕਿ ਸਾਰੇ ਨੋਬ ਅਸੀਂ ਗੈਸ ਸਟੋਵ ਦੇ ਬੰਦ ਕਰ ਦਿੱਤੇ ਹਨ ਜੋ ਖਾਣਾ ਪਕਾਇਆ ਹੈ ਉਹਨੂੰ ਅਸੀਂ ਢੱਕ ਦਿੱਤਾ ਹੈ ਕਿ ਨਹੀਂ ਢੱਕ ਦਿੱਤਾ ਇਹ ਇਹੋ ਜਿਹੀਆਂ ਕਿਸਮ ਦੀਆਂ ਸਾਵਧਾਨੀਆਂ ਹਰ ਵੇਲੇ ਜ਼ਰੂਰੀ ਹਨ